ਸਤਿ ਸ਼੍ਰੀ ਆਕਾਲ ਭਾਈ ਹਾਂਜੀ ਆਪਾਂ ਕੁਛ ਪਨੀਰੀ ਬੀਜਣੀ ਸੀਗੀ ਅਤੇ ਗਰਮੀ ਵਾਹਲੀ ਹੈ ਜਾਂ ਉਸ ਵਾਸਤੇ ਕਿੰਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ

ਠੀਕ ਹੈ ਠੀਕ ਹੈ ਠੀਕ ਹੈ ਅਤੇ ਪਾਣੀ ਵਗੈਰਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ

ਠੀਕ ਹੈ ਰੂੜੀ ਦੀ ਖਾਦ ਵਗੈਰਾ ਵੀ ਪਾ ਸਕਦੇ ਆ ਅੱਛਾ ਅੱਛਾ ਠੀਕ ਆ ਰੂੜੀ ਦੀ ਖਾਦ ਵਗੈਰਾ ਵੀ ਪਾ ਸਕਦੇ ਆ

ਠੀਕ ਹੈ ਠੀਕ ਹੈ ਬਰੀਕ ਬ ਬਰੀਕ ਕਰਕੇ

ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜ਼ਿਆਦਾ ਵਰਤਣ ਲੱਗ ਜਾਵੇ ਇਹਦੇ ਨਾਲ ਪੈਸਾ ਪੈਸਾ ਬਣਉਣ ਲਈ ਥੋੜ੍ਹਾ ਜਿਹਾ ਵੱਧ ਬਣ ਜਾਂਦਾ ਫਿਰ ਓਈਆਂ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਖੁਰਾਕਾਂ ਦੇ ਵਿੱਚ ਕੁਝ ਹੈਗਾ ਨਹੀਂ ਹਾਂ ਤੱਤ ਤੱਤ ਨਹੀਂ ਰਹਿੰਦੇ ਫਿਰ ਖ ਖਤਮ ਫਸਲਾਂ ਦੇ ਵਿੱਚ ਠੀਕ ਹੈ ਠੀਕ ਹੈ ਬਿਮਾਰੀਆਂ ਫਿਰ ਇਸੇ ਕਰਕੇ ਹੈ ਜੀ ਹਾਂ ਝਾੜ ਵੱਧ ਗਏ ਰੇਹਾਂ ਸਪਰੇਹਾਂ ਵੱਧ ਗਈਆਂ ਪਹਿਲਾਂ ਕੋਈ ਹੁੰਦੀ ਸੀ ਔਰਗੈਨਿਕ ਖੇਤੀਆਂ ਹੁੰਦੀਆਂ ਸਾਰੀਆਂ ਕੁਦਰਤੀ ਬੱਸ ਕੋਈ ਰੇਹਾਂ ਨਹੀਂ ਸੀ ਸਪਰੇਹਾਂ ਨਹੀਂ ਸੀਗੀਆਂ ਝਾੜ ਭਵਾਂ ਦੀ ਘੱਟ ਸੀਗੇ ਕੋਈ ਬਿਮਾਰੀਆਂ ਨਹੀਂ ਹੁੰਦੀਆਂ ਸੀ ਹੁਣ ਬਿਮਾਰੀਆਂ 'ਤੇ ਪੈਸੇ ਲੱਗ ਜਾਂਦੇ ਨੇਗੇ ਓਨੇ ਹਾਂ ਕੁਛ ਨਹੀਂ ਸੀਗਾ ਉਦੋਂ ਇਹਨਾਂ ਚੀਜ਼ਾਂ ਦਾ ਬਿਮਾਰੀ ਦਾ ਕੋਈ ਵੀ ਨਹੀਂ ਸੀ ਚੰਗੇ ਸਿਹਤਮੰਦ ਪਸ਼ੂ ਹੁੰਦੇ ਸਿਹਤਮੰਦ ਹੀ ਬੰਦੇ ਹੁੰਦੇ ਆਪਦਾ ਕੁਦਰਤੀ ਖੇਤੀ ਜਿਹੜੀ ਹੁੰਦੀ ਸੀ ਉਦੋਂ ਬਹੁਤ ਵਧੀਆ ਸੀਗੀ ਸਤਿ ਸ਼੍ਰੀ ਅਕਾਲ ਭਾਈ